ਜੀ ਜੇ ਆਪਾਂ ਗੱਲ ਕਰੀਏ ਸੈਰ ਸਪਾਟਾ ਸਥਾਨ ਸੈਰ ਸਪਾਟਾ ਸਥਾਨ ਅੱਜ ਦੇ ਸਮੇਂ ਲਈ ਬਹੁਤ ਹੀ ਜ਼ਰੂਰੀ ਹੋ ਚੁੱਕੇ ਹਨ ਅਤੇ ਸਰਕਾਰ ਨੂੰ ਜਾਂ ਗ੍ਰਾਮ ਪੰਚਾਇਤ ਨੂੰ ਇਸ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਦਾ ਵਾਤਾਵਰਨ ਜਿਸ ਤਰ੍ਹਾਂ ਦੇ ਮੌਸਮ ਅੱਜ ਦੇ ਹੋ ਚੁੱਕੇ ਹਨ ਉਸ ਲਈ ਸਾਨੂੰ ਗਰੀਨਰੀ ਦੀ ਪੌਦੇ ਲਗਾਉਣ ਦੀ ਬਹੁਤ ਜ਼ਰੂਰਤ ਹੈ ਅਤੇ ਪੌਦੇ ਲਗਾ ਕੇ ਉੱਥੇ ਸੈਰ ਸਪਾਟਾ ਕਰਨ ਨਾਲ ਸਾਡੇ ਸਰੀਰ ਨੂੰ ਆਕਸੀਜਨ ਦੀ ਮਾਤਰਾ ਭਰਪੂਰ ਮਿਲ ਸਕਦੀ ਹੈ ਅਤੇ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜੋ ਕਿ ਖ਼ਤਮ ਹੋ ਸਕਦੀਆਂ ਹਨ ਤਾਂ ਆਪਣੇ ਹਰ ਕਿਸੇ ਦੇ ਨਜ਼ਦੀਕ ਜਾਂ ਆਪਾਂ ਕਹਿ ਸਕਦੇ ਕਿ ਆਪਣੇ ਦਾਇਰੇ ਦੇ ਵਿੱਚ ਇੱਕ ਸੈਰ ਸਪਾਟਾ ਸਥਾਨ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਇੱਕ ਪਾਰਕ ਦੇ ਰੂਪ 'ਚ ਹੋ ਸਕਦਾ ਹੈ ਜਾਂ ਕੋਈ ਖੁੱਲ੍ਹੇ ਮੈਦਾਨ ਦੇ ਰੂਪ 'ਚ ਹੋ ਸਕਦਾ ਹੈ ਜਿੱਥੇ ਕੋਈ ਵੀ ਆਦਮੀ ਆਪਣੇ ਪਰਿਵਾਰ ਦੇ ਨਾਲ ਜਾਂ ਇਕੱਲਾ ਯੋਗਾ ਕਰ ਸਕਦਾ ਹੈ ਐਕਸਰਸਾਈਜ਼ ਕਰ ਸਕਦਾ ਹੈ ਸੈਰ ਕਰ ਸਕਦਾ ਹੈ ਅਤੇ ਆਪਣੇ ਸਰੀਰ ਨੂੰ ਸੰਭਾਲ ਕੇ ਰੱਖ ਸਕਦਾ ਕਿਉਂਕਿ ਇੱਕ ਤੰਦਰੁਸਤ ਸਰੂਰ ਸਰੀਰ ਲਈ ਸੈਰ ਸਪਾਟਾ ਜਾਂ ਯੋਗਾ ਜਾਂ ਆਪਾਂ ਕਹਿ ਸਕੀਏ ਐਕਸਸਾਈਜ਼ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਰਕੇ ਮੇਰੀ ਸਰਕਾਰ ਨੂੰ ਜਾਂ ਮੇਰੀ ਗ੍ਰਾਮ ਪੰਚਾਇਤ ਨੂੰ ਇਹ ਬੇਨਤੀ ਹੈ ਕਿ ਹਰ ਪੱਚੀ ਜਾਂ ਤੀਹ ਘਰਾਂ ਦੇ ਪਿੱਛੇ ਇੱਕ ਛੋਟਾ ਪਾਰਕ ਹੋਣਾ ਚਾਹੀਦਾ ਹੈ ਜਾਂ ਪੰਜਾਹ ਜਾਂ ਸੌ ਘਰਾਂ ਦੇ ਪਿੱਛੇ ਇਕ ਵੱਡਾ ਪਾਰਕ ਹੋਣਾ ਚਾਹੀਦਾ ਹੈ ਜਿੱਥੇ ਕਿ ਵੀਹ ਜਾਂ ਪੱਚੀ ਫੈਮਿਲੀਆਂ ਐਟ ਏ ਟਾਈਮ ਇੱਕੋ ਸਮੇਂ 'ਤੇ ਸੈਰ ਸਪਾਟਾ ਕਰ ਸਕਣ ਐਕਸਰਸਾਈਜਾਂ ਕਰ ਸਕਣ ਯੋਗਾ ਕਰ ਸਕਣ ਅਤੇ ਉਥੋਂ ਦੀ ਗਰੀਨਰੀ ਜੋ ਕਿ ਪਾਰਕ ਦੇ ਵਿੱਚ ਭਰਪੂਰ ਮਾਤਰਾ ਵਿੱਚ ਲੱਗੀ ਹੋਣੀ ਚਾਹੀਦੀ ਹੈ ਤਾਂ ਕਿ ਉਥੋਂ ਅਸੀਂ ਆਕਸੀਜਨ ਲੈ ਸਕੀਏ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕੀਏ ਧੰਨਵਾਦ